ਸਾਡੇ ਸਿੱਖ ਧਰਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਨਾਲ ਨਿਵਾਜਿਆ ਗਿਆ ਹੈ ਅਤੇ ਇਸ ਵਿੱਚ ਗੁਰੂ ਕੀ ਲਾਡਲੀ ਫੌਜ ਖਾਲਸਾ ਜੋ ਸਾਹਿਬ ਸ਼੍ਰੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜੀ ਸੀ ਆਨੰਦਪੁਰ ਸਾਹਿਬ ਵਿੱਚ ਸੋਲ੍ਹਾਂ ਸੌ ਨੜਿਨਵੇਂ ਵਿੱਚ ਅਤੇ ਉਹਨਾਂ ਨੂੰ ਪੰਜ ਕਕਾਰ ਪ੍ਰਦਾਨ ਕੀਤੇ ਗਏ ਸੀਗੇ ਸਿਰ 'ਤੇ ਬੰਨ੍ਹਣ ਲਈ ਜੋ ਪਗੜੀ ਹੁੰਦੀ ਹੈ ਉਹਦੇ ਵਿੱਚ ਇੱਕ ਕੰਘਾ ਦਿੱਤਾ ਗਿਆ ਸੀ ਪੰਜ ਕਕਾਰਾਂ 'ਚ ਕੰਘਾ ਹੈ ਕੜਾ ਹੈ ਕਿਰਪਾਨ ਹੈ ਕਛਹਿਰਾ ਹੈ ਅਤੇ ਕੇਸ ਹੈ ਇਹ ਪੰਜ ਚਿੰਨ ਜਿਹੜਾ ਵੀ ਸਿੱਖ ਧਾਰਨ ਕਰਦਾ ਹੈ ਉਹਨੂੰ ਖਾਲਸਾ ਕਹਿੰਦੇ ਹਨ

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਹੋਰ ਗ੍ਰੰਥ ਦਸਮ ਗ੍ਰੰਥ ਵੀ ਲਿਖਿਆ ਹੈ ਉਸ ਗ੍ਰੰਥ ਵਿੱਚ ਵੀ ਗੁਰੂ ਸਾਹਿਬ ਬਹੁਤ ਸਾਰੇ ਅਧਿਆਤਮਿਕ ਰਹੱਸਾਂ ਤੋਂ ਪੜਦਾ ਚੁੱਕਦੇ ਹਨ ਉਹ ਵੀ ਉਹ ਗ੍ਰੰਥ ਵੀ ਸਿੱਖ ਸਮਾਜ ਵਿੱਚ ਬਹੁਤ ਸਨਮਾਨ ਅਤੇ ਪੂਜਾ ਦਾ ਹੱਕਦਾਰ ਹੁੰਦਾ ਹੈ ਧੰਨਵਾਦ